ਸਚਿਨ ਤੰਦੂਲਕਰ ਕਪਿਲ ਦੇਵ ਵਿਰਾਟ ਕੋਹਲੀ ਸਰਦਾਰ ਮਿਲਖਾ ਸਿੰਘ ਪੀਟੀ ਊਸ਼ਾ ਆਫ ਰੈਡ ਟਰੈਕਿੰਗ ਸਚਿਨ ਤੰਦੂਰਕਰ ਮਾਸਟਰ ਬਲਾਸਟਰ ਹਰਭਜਨ ਸਿੰਘ ਸਾਨੀਆ ਮਿਰਜ਼ਾ